ਹੈਲੋ ਆਪ ਕਸ਼ੀਸ਼ ਮੈਮ ਬਾਤ ਕਰ ਰਹੇ ਹੋ ਮੈਮ ਮੈਂ ਨਾ ਆਪਕੋ ਲਾਸਟ ਵੀਕ ਆਪਕੋ ਸੂਟ ਦੇ ਕੇ ਗਈ ਸੀ ਆਪਨਾ ਸਟਿਚ ਕਰਵਾਨੇ ਕੇ ਲੀਏ ਹਾਂਜੀ ਸੋ ਵੋ ਨਾ ਮੇਰੇ ਕੋ ਅਰਜੈਂਟ ਚਈਏ ਆਪਨੇ ਵੋ ਸਟਾਰਟ ਕਰ ਦੀਆਂ ਸਿਲਨਾ ਯਾ ਅਭੀ ਸਿਲਨਾ ਹੈ ਬਸ ਮੈਮ ਮੇਰੇ ਕੋ ਵੋ ਅਰਜੈਂਟ ਚਈਏ ਏਕ ਦੋ ਦਿਨ ਮੇ ਕਿਉਂਕਿ ਫੰਕਸ਼ਨ ਹੈ ਹਮਾਰੇ ਯਹਾਂ ਤੋਂ ਹਾਂਜੀ ਜਿਤਨੀ ਜਲਦੀ ਹੋ ਕੋਸ਼ਿਸ਼ ਕਰੋ ਮੇਰੇ ਕੋ ਅਰਜੈਂਟ ਚਈਏ ਵੋ ਔਰ ਅਗਰ ਮੇਰੇ ਕੋ ਨਾ ਹੋਤਾ ਤੋ ਮੈਂ ਆਪਸੇ ਕਹਿਤੀ ਨਾ ਇਸ ਲੀਏ ਮੈਂ ਆਪਕੋ ਪਹਿਲੇ ਹੀ ਲਾਸਟ ਵੀਕ ਦੇ ਕੇ ਗਈ ਹੂੰ

ਪਰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਗਈ ਸੀ ਕਿ ਤੁਸੀਂ ਕਰ ਦਿਓ ਸਟਿਚ ਜਲਦੀ ਫਿਰ ਵੀ ਤੁਸੀਂ ਨਹੀਂ ਕੀਤਾ ਹਾਂਜੀ ਹਾਂਜੀ ਅਤੇ ਹਾਂਜੀ ਤੁਹਾਨੂੰ ਡਿਜ਼ਾਈਨ ਵਗੈਰਾ ਹੈ ਯਾਦ ਜਾਂ ਫਿਰ ਮੈਂ ਦੁਬਾਰਾ ਤੋਂ ਦੱਸਾ ਕੁਛ ਕਿਉਂਕਿ ਮੈਂ ਸਾਰਾ ਤੁਹਾਨੂੰ ਡਿਟੇਲ ਵਿੱਚ ਦੱਸ ਕੇ ਗਈ ਸੀ ਉਦੋਂ ਵੀ ਕਿਵੇਂ ਡਰੈਸ ਸਟਿਚ ਕਰਨੀ ਹੈ ਹਾਂਜੀ ਠੀਕ ਹੈ ਉਹ ਵੀ ਮੈਂ ਕਰ ਦਾਂਗੀ ਅਤੇ ਕਦੋਂ ਤੱਕ ਫੇਰ ਕਰ ਦਿਓਗੇ ਤੁਸੀਂ ਹਾਂਜੀ ਤਾਂ ਫਿਰ ਤੁਸੀਂ ਤੀਹ ਤਰੀਕ ਤੱਕ ਕਰ ਸਕਦੇ ਹੋ ਟਰਾਈ ਨਹੀਂ ਤੁਸੀਂ ਤੁਹਾਨੂੰ ਕਰਨਾ ਪਏਗਾ ਕਿਉਂਕਿ ਫਿਰ ਮੈਨੂੰ ਚਾਹੀਦਾ ਕਿਉਂਕਿ ਅੱਗੇ ਹੀ ਇੰਨਾ ਟਾਈਮ ਹੋ ਚੁੱਕਿਆ ਇਸ ਕਰਕੇ ਫਿਰ ਤੁਸੀਂ ਕਰ ਦਿਓ ਤੀਹ ਤਰੀਕ ਤੱਕ ਜਿੰਨਾ ਹੋ ਸਕੇ ਜਲਦੀ ਹਾਂਜੀ ਕਰ ਦੇਣਾ ਅਤੇ ਮੈਂ ਤੁਹਾਨੂੰ ਡਿਜ਼ਾਇਨ ਵਗੈਰਾ ਵੀ ਸੈਂਡ ਕਰ ਦਾਂਗੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਅਤੇ ਅੱਛਾ ਕਰ ਦਿਆ ਜੇ ਇਹ ਹਾਂਜੀ ਅਤੇ ਹਾਂਜੀ ਅਤੇ ਕੀ ਕਹਿੰਦੇ ਹੈ ਇਹਦੀ ਪੇਮੈਂਟ ਵਗੈਰਾ ਵੀ ਫੇਰ ਮੈਨੂੰ ਦੱਸ ਦਿਓ ਤੁਸੀਂ ਮੈਂ ਤੁਹਾਨੂੰ ਉਹ ਵੀ ਕਰ ਦਾਂਗੀ ਸੈਂਡ ਹਾਂਜੀ ਅਸੀਂ ਹਾਂਜੀ ਕੋਈ ਹਾਫ ਪੇਮੈਂਟ ਦਾ ਇਸ਼ੂ ਤਾਂ ਨਹੀਂ ਹੈ ਬਈ ਅਗਰ ਕਈ ਵਾਰੀ ਇੱਦਾਂ ਹੁੰਦਾ ਕਿ ਕੋਈ ਹਾਫ ਪੇਮੈਂਟ ਜ਼ਰੂਰ ਲੈਂਦੇ ਨੇ ਮੋਸਟਲੀ ਹੁੰਦਾ ਇਸ ਕਰਕੇ ਮੈਂ ਪੁੱਛਦੀ ਤੁਹਾਨੂੰ ਅਗਰ ਹੈ ਤਾਂ ਫਿਰ ਮੈਂ ਤੁਹਾਨੂੰ ਹਾਫ ਪੇਮੈਂਟ ਭੇਜ ਦਿੰਦੀ ਹਾਂ ਅਤੇ ਫੇਰ ਬਾਕੀ ਮੈਂ

ਹਾਂਜੀ ਠੀਕ ਹੈ ਫਿਰ ਤੁਸੀਂ ਮੈਨੂੰ ਕੋਲ ਕਰ ਦੇਣਾ ਜਦੋਂ ਹੋ ਜਾਏ ਅਤੇ ਮੈਂ ਫਿਰ ਕਰ ਲਾਂਗੀ ਟਰਾਈ ਹਾਂਜੀ ਠੀਕ ਹੈ ਓਕੇ ਬਾਏ